ਭਾਰਤ ਵਿੱਚ ਵੱਖ ਵੱਖ ਸਟੇਟ ਹਨ ਅਤੇ ਵੱਖ ਵੱਖ ਖਿੱਤਿਆਂ ਦੀ ਵੱਖ ਵੱਖ ਜਿਹੜੀ ਭਾਸ਼ਾ ਵੀ ਹੈ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਪੰਜਾਬੀ ਹਿੰਦੀ ਤਾਮਿਲ ਤੇਲਗੂ ਕੰਨੜ ਮਲਿਆਲਮ ਮਰਾਠੀ ਬੰਗਾਲੀ ਕਸ਼ਮੀਰੀ ਡੋਗਰੀ ਇਹ ਜਿਹੜੀਆਂ ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਵੀ ਨੇ ਜਿਨ੍ਹਾਂ ਦੇ ਵਿੱਚ ਸਰਕਾਰੀ ਕੰਮਕਾਜ ਹੁੰਦਾ ਹੈ ਇਹ ਸਰਕਾਰੀ ਭਾਸ਼ਾਵਾਂ ਸਰਕਾਰ ਦੁਆਰਾ ਨਿਸ਼ਚਿਤ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਨੇ ਕੰਮਕਾਜ ਹੈ ਜਿਹੜਾ ਉਹ ਕਰਵਾਉਣਾ ਹੁੰਦਾ ਹੈ ਦੇਸ਼ ਦੇ ਹੋਰ ਖਿੱਤਿਆਂ 'ਚ ਜਿਹੜੀਆਂ ਬੋਲੀਆਂ ਜਾਣ ਵਾਲੀਆਂ ਆਮ ਜਿਹੜੀਆਂ ਬੋਲੀਆਂ ਹੁੰਦੀਆਂ ਨੇ ਉਹਨਾਂ ਨੂੰ ਉਪਭਾਸ਼ਾਵਾਂ ਵੀ ਕਹਿ ਦਿੱਤਾ ਜਾਂਦਾ ਹੈ ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਹਰਿਆਣੇ ਦੇ ਵਿੱਚ ਹਰਿਆਣਵੀ ਵਾਂਗਰੂ ਬਿਹਾਰੀ ਬਾਗੜੀ ਆਦਿ ਇਸ ਤਰ੍ਹਾਂ ਦੀਆਂ ਉਪਭਾਸ਼ਾਵਾਂ ਨੇ ਜਿਵੇਂ ਪੰਜਾਬ ਦੇ ਵਿੱਚ ਆਪਾਂ ਪੰਜਾਬੀ ਦੀਆਂ ਜਿਹੜੀਆਂ ਉਪਭਾਸ਼ਾਵਾਂ ਜਾਂ ਉਪਬੋਲੀਆਂ ਨੇ ਉਹਨਾਂ ਦੀ ਗੱਲ ਕਰ ਸਕਦੇ ਹਾਂ ਜਿਹਦੇ ਵਿੱਚ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਉਪਬੋਲੀਆਂ ਬੋਲੀਆਂ ਜਾਂਦੀਆਂ ਨੇ ਜਿਵੇਂ ਮਾਝੀ ਮਲਵਈ ਦੁਆਬੀ ਪੁਆਧੀ ਇਹ ਖਿੱਤਿਆਂ ਦੇ ਨਾਲ ਖੇਤਰਾਂ ਦੇ ਨਾਲ ਸੰਬੰਧਿਤ ਨੇ ਜਿਹਦੇ ਵਿੱਚ ਵੱਖ ਵੱਖ ਜ਼ਿਲ੍ਹੇ ਵੀ ਆਉਂਦੇ ਨੇ ਪੰਜਾ ਦੇਸ਼ ਦੀ ਭਾਸ਼ਾਈ ਵਿਭਿੰਨਤਾ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਭਾਸ਼ਾਵਾਂ ਵੱਖ ਵੱਖ ਨੇ ਪਰ ਫੇਰ ਵੀ ਉਹ ਉਸ ਖਿੱਤੇ ਦੀ ਇੱਕ ਵੱਖਰਤਾ ਨੂੰ ਦਰਸਾਉਂਦੀਆਂ ਨੇ ਜਿੱਥੇ ਕਿ ਉਹ ਬੋਲੀਆਂ ਜਾਂਦੀਆਂ ਨੇ ਖਿੱਤੇ ਦੀ ਵੱਖਰਤਾ ਹੀ ਬੋਲੀ ਦੇ ਰਾਹੀਂ ਹੀ ਪਛਾਣੀ ਜਾਂਦੀ ਹੈ ਇਹ ਵਿਭਿੰਨਤਾ ਹੈ ਜਿਹੜੀ ਇਹ ਸਾਰੇ ਦੇਸ਼ ਦੀਆਂ ਬੋਲੀਆਂ ਦੇ ਵਿੱਚ ਪਾਈ ਜਾਂਦੀ ਹੈ ਭਾਸ਼ਾਵਾਂ ਦੇ ਵਿੱਚ ਪਾਈ ਜਾਂਦੀ ਹੈ